ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਬਣਾ ਦਵਾਂਗੇ ਹਫ਼ਤੇ ਕੁ ਤੱਕ ਲੈ ਜਿਓ ਤੁਸੀਂ ਇੱਕ ਤੁਸੀਂ ਇੱਕ ਵਾਰੀ ਬੂਟੀਕ ਆ ਜਿਓ ਫਿਰ ਉੱਥੇ ਬਹਿ ਕੇ ਹੀ ਤੁਸੀਂ ਨਾਲੇ ਆਪਣਾ ਨਾਪ ਦੇ ਜਿਓ ਅਤੇ ਨਾਲੇ ਆਪਣੇ ਕੱਪੜੇ ਵਗੈਰਾ ਦਾ ਵੀ ਦੱਸ ਦਿਓ ਫਿਰ ਉੱਥੇ ਬਹਿਕੇ ਹੀ ਪੈਸੇ ਦਾ ਵੀ ਕਰਲਵਾਂਗੇ ਠੀਕ ਹੈ ਕਦੋਂ ਆਉਗੇ ਤੁਸੀਂ ਫਿਰ ਠੀਕ ਹੈ ਥੈਂਕ ਯੂ